ਹੈਲੋ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਬਰਾ ਰੈਸਟੋਰੈਂਟ 'ਚੋ ਬੋਲ ਰਹੇ ਹੋ ਮੈਂ ਤੁਹਾਡੇ ਪਿੰਡ ਨਾਲ ਝੁੰਬੇ ਬੋਲ ਰਹੀ ਹਾਂ ਮੇਰੇ ਮੇਰੇ ਘਰ ਮੇਰੀ ਛੋਟੀ ਸਿਸਟਰ ਦਾ ਬਰਡੇ ਆ ਇਸ ਕਰਕੇ ਮੈਂ ਤੁਹਾਡੇ ਰੈਸਟੋਰੈਂਟ 'ਚ ਦਸ ਡੱਬੇ ਮਠਿਆਈ ਦੇ ਔਡਰ ਕਰਨਾ ਚਾਹੁੰਦੀ ਹਾਂ ਮੇਰੇ ਘਰ ਪਿਛਲੀ ਵਾਰ ਮੈਂ ਤੁਹਾਨੂੰ ਔਡਰ ਦਿੱਤਾ ਸੀ ਉਸ ਵਿੱਚ ਵਿੱਚ ਤੁਸੀਂ ਮਿੱਠਾ ਜ਼ਿਆਦਾ ਪਾਤਾ ਸੀ ਮੇਰੇ ਘਰ ਦੇ ਇੰਨਾ ਮਿੱਠਾ ਲਾਇਕ ਨਹੀਂ ਕਰਦੇ ਅਤੇ ਐਤਕੀ ਰਿਸ਼ਤੇਦਾਰ ਵੀ ਆ ਰਹੇ ਆ ਉਹ ਵੀ ਇੰਨਾ ਮਿੱਠਾ ਨਹੀਂ ਖਾਂਦੇ ਅਤੇ ਮੈਂ ਚਾਹੁੰਦੀ ਹਾਂ ਤੁਸੀਂ ਐਤਕੀ ਮਿੱਠਾ ਘੱਟ ਪਾਓ ਅਤੇ ਪਿਛਲੀ ਵਾਰ ਵਾਂਗੂੰ ਮਿੱਠਾ ਬੇਸਟ ਨਾ ਹੋਵੇ ਮਿਠਾਈ ਵੇਸਟ ਨਾ ਹੋਵੇ ਅਤੇ ਮੈਂ ਚਾਹੁੰਦੀ ਹਾਂ ਐਤਕੀ ਮਿੱਠਾ ਘੱਟ ਪਾਓ ਅਤੇ ਰਿਸ਼ਤੇਦਾਰ ਅਤੇ ਮੇਰੀ ਫੈਮਿਲੀਸ ਵੱਧ ਤੋਂ ਵੱਧ ਮਠਿਆਈ ਖਾ ਖਾਣ ਅਤੇ ਜੇ ਤੁਸੀਂ ਮਿੱਠਾ ਜ਼ਿਆਦਾ ਪਾਇਆ ਤਾਂ ਅਤੇ ਮੈਂ ਤੁਹਾਨੂੰ ਪੇਮੈਂਟ ਘੱਟ ਤੋਂ ਘੱਟ ਕਰੂ ਜੇ ਤੁਸੀਂ ਪੂਰਾ ਪਾਇਆ ਤਾਂ ਮੈਂ ਤੁਹਾਨੂੰ ਪੂਰੀ ਪੇਮੈਂਟ ਕਰ ਦਊਗੀ ਜੇ ਮਿੱਠਾ ਮਤਲਬ ਸਵਾਦ ਬਣੇ ਅਤੇ ਮੈਂ ਤੁਹਾਡੇ ਅਗਲੀ ਵਾਰ ਵੀ ਤੁਹਾਡੇ ਰੈਸਟੋਰੈਂਟ ਚੋ ਹੀ ਔਡਰ ਕਰਾਂਗੀ ਜੇ ਤੁਸੀਂ ਐਤਕੀ ਵਧੀਆ ਮਠਿਆਈ ਬਣਾਈ ਅਤੇ ਤੁਸੀਂ ਇਹ ਮੈਂ ਤੁਹਾਨੂੰ ਪੈਸੇ ਪੇਟੀਐਮ ਕਰ ਦਊਗੀ ਅਤੇ ਤੁਸੀਂ ਜਾਂ ਸੁਬਾਹ ਜਾਂ ਸ਼ਾਮ ਮੇਰੇ ਘਰ ਤੱਕ ਪਹੁੰਚਾ ਦਿਓ ਜਿਵੇਂ ਮੈਂ ਕਹਿ ਰਹੀ ਹਾਂ ਉਵੇਂ ਜੇ ਮਠਿਆਈ ਬਣ ਜਾਏ ਤਾਂ ਵਧੀਆ